ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੁਸੀਂ ਅ ਆਉਣਾ ਕਦੋਂ ਹੈ ਜੀ ਕਦੋਂ ਤੁਸੀਂ ਵਿਜਿਟ ਕਰਨਾ ਅਤੇ ਮੈਂ ਉਸ ਹਿਸਾਬ ਨਾਲ ਪਹਿਲਾਂ ਮੈਂ ਆਪਣੀ ਅਵੇਲੇਬਿਲਟੀ ਚੈੱਕ ਕਰ ਲਵਾਂ ਕਿ ਅਸੀਂ ਫਰੀ ਹੋਵਾਂਗੇ ਉਸ ਟਾਈਮ ਠੀਕ ਹੈ ਜੀ ਓਕੇ ਹਾਂਜੀ ਹਾਂ ਅਸੀਂ ਅਵੇਲੇਬਲ ਹੈ ਜੀ ਉਸ ਟਾਈਮ ਅਤੇ ਅਸੀਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਉਹਨਾਂ ਦੇ ਲਾਹੌਰ ਦਰਬਾਰ ਹੋਰ ਦਿਖਾਵਾਂਗੇ ਫੋਟ ਦਿਖਾਵਾਂਗੇ ਮੋਸਕ ਹੈ ਨਾ ਉਹਨਾਂ ਦਾ ਅਤੇ ਆਪਣਾ ਗੁਰਦੁਆਰਾ ਡੇਰਾ ਸਾਹਿਬ ਹੈ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਉਹ ਵਿਖਾਵਾਂਗੇ ਜੀ ਅਤੇ ਬਾਕੀ ਜਿੱਥੇ ਉਹਨਾਂ ਦੀ ਹੈ ਨਾ ਫਿਊਨਰਲ ਹੈ ਮਤਲਬ ਜਿੱਥੇ ਉਹਨਾਂ ਦਾ ਅੰਤਿਮ ਉਹ ਹੋਇਆ ਸੀਗਾ ਅਤੇ ਬਾਕੀ ਉਹਨਾਂ ਦੀ ਜਨਮ ਸਥਾਨ ਜਿਹੜਾ ਕਿ ਬਡਰੁੱਖਾਂ ਪਿੰਡ ਹੈ ਅਤੇ ਅਸੀਂ ਇਹ ਸਾਰੀਆਂ ਸਾਈਟਸ ਕੁੱਲ ਮਿਲਾ ਕੇ ਸਾਡੇ ਕੋਲ ਜਿਹੜੀਆਂ ਹੈਗੀਆਂ ਨੇ ਪੰਦਰਾਂ ਸਾਈਟ ਨੇ ਜਿਹੜੀਆਂ ਅਸੀਂ ਤੁਹਾਨੂੰ ਵਿਜਿਟ ਕਰਵਾ ਸਕਦੇ ਹਾਂ ਜੀ ਇਹ ਤੁਹਾਡੇ ਉੱਤੇ ਆ ਜੀ ਤੁਸੀਂ ਕਿੰਨਾ ਟਾਈਮ ਦੇਣਾ ਚਾਹੁੰਦੇ ਹੋ ਅਤੇ ਉਸ ਹਿਸਾਬ ਨਾਲ ਅਸੀਂ ਤੁਹਾਨੂੰ ਉਹਨਾਂ ਦੀ ਸਾਰੀਆਂ ਨੀਤੀਆਂ ਰਣਨੀਤੀਆਂ ਕਿਸ ਹਿਸਾਬ ਨਾਲ ਉਹਨਾਂ ਨੇ ਸਿੱਖ ਅੰਪਾਇਰ ਖੜ੍ਹਾ ਕੀਤਾ ਅਤੇ ਕਿਵੇਂ ਚਲਾਇਆ ਅਤੇ ਉਹਨਾਂ ਦੇ ਆਪਣੇ ਪ੍ਰਜਾ ਲਈ ਕਿਵੇਂ ਕਿਵੇਂ ਦੀਆਂ ਪੋਲਸੀਆਂ ਸਾਰਾ ਕੁਛ ਨਾਲੇ ਦੱਸਾਂਗੇ ਨਾਲੇ ਦਿਖਾਵਾਂਗੇ ਸਰ ਸਾਡੇ ਚਾਰਜਿਸ ਸੀ ਵਨ ਥਾਊਸੈਂਡ ਪਰ ਪਰਸਨ ਹੈ ਇਹ ਹੈਗਾ ਜੀ ਅਗਰ ਤੁਸੀਂ ਜੇ ਦੋ ਦਿਨ ਲਈ ਆਉਂਦੇ ਹੋ ਅਤੇ ਅਗਰ ਤੁਹਾਡਾ ਤੁਸੀਂ ਮੈਨੂੰ ਦੱਸ ਸਕਦੇ ਹੋ ਕਿੰਨੇ ਟਾਈਮ ਲਈ ਆਉਣਾ ਅੱਛਾ ਜੀ ਇੱਕ ਦੇਖੋ ਜੀ ਜੇ ਤੁਸੀਂ ਸਾਰੀਆਂ ਸਾਈਟਸ ਕਵਰ ਕਰਨਾ ਚਾਹੁੰਦੇ ਹੋ ਤਾਂ ਅਸੀਂ ਇਹ ਇੱਕ ਹਫਤੇ ਦੇ ਵਿੱਚ ਕਵਰ ਕਰਵਾ ਦੇਵਾਂਗੇ ਅਤੇ ਸਾਡਾ ਫਿਰ ਪੈਕੇਜ ਹੋਵੇਗਾ ਤੁਹਾਡੇ ਅਗਰ ਦਸ ਮੈਂਬਰ ਤੋਂ ਘੱਟ ਹੋ ਤੁਸੀਂ ਠੀਕ ਹੈ ਜੀ ਫਿਰ ਅਸੀਂ ਸਾਡਾ ਪੈਕੇਜ ਰਹੇਗਾ ਵੀਹ ਹਜ਼ਾਰ ਦਾ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਕੋਈ